ਹੈਲੋ ਹਾਂਜੀ ਹਾਂਜੀ ਹਾਂਜੀ ਦੱਸੋ ਪਰਸੋਂ ਜੀ ਛੁੱਟੀ ਮਤਲਬ ਸੰਡੇ ਨੂੰ ਹਸਪਤਾਲ ਸਰ ਬੰਦ ਹੁੰਦੇ ਜੀ ਸਰ ਨਹੀਂ ਬਹਿੰਦੇ ਤੁਸੀਂ ਸਰ ਕੱਲ੍ਹ ਨੂੰ ਆ ਜਾਇਓ ਡਾਕਟਰ ਨੌਂ ਤੋਂ ਸ਼ਾਮ ਤੱਕ ਹੁੰਦੇ ਨੇ ਵਿੱਚ ਲੰਚ ਟੈਮ ਤਾਂ ਬ੍ਰੇਕ ਲੈਂਦੇ ਨੇ ਨੇ ਹਾਂਜੀ ਹਾਂਜੀ ਹਾਂਜੀ ਲੈ ਆਇਓ ਵੈਸੇ ਤੁਹਾਨੂੰ ਦਿੱਕਤ ਕੀ ਹੈ ਜੀ ਮਤਲਬ ਬੁਖ਼ਾਰ ਉੱਤਰਦਾ ਨਹੀਂ ਪਿਆ ਜੀ ਕਿੰਨਾ ਕੁ ਟੈਮ ਹੋ ਗਿਆ ਜੀ ਬੁਖ਼ਾਰ ਚੜ੍ਹਦੇ ਨੂੰ ਕੋਈ ਟੈਸਟ ਕਰਵਾਇਆ ਹੈ ਕੇ ਈ ਵੈਸੇ ਦਵਾਈ ਲੈ ਰਹੇ ਹੋ ਪਹਿਲਾਂ ਤੁਸੀਂ ਸਰ ਕਿੱਥੋਂ ਦਵਾਈ ਲੈਤੀ ਸੀ ਜੀ ਠੀਕ ਹੈ ਜੀ ਕੋਈ ਨਾ ਸਰ ਤੁਸੀਂ ਮਤਲਬ ਕੱਲ੍ਹ ਨੂੰ ਆ ਜਾਇਓ ਤੁਹਾਨੂੰ ਸਰ ਕਿੰਨਾ ਕੁ ਟੈਮ ਹੋ ਗਈ ਦਰਦ ਹੁੰਦੇ ਨੂੰ ਮਤਲਬ ਕਿਵੇਂ ਜੀ ਹੁੰਦਾ ਜੀ ਕੋਈ ਨਾ ਸਰ ਤੁਹਾਡੀ ਮਤਲਬ ਅਲਟਰਾਸਾਊਡ ਕਰਵਾ ਲਾਂਗੇ ਇੱਕ ਵਾਰ ਤੁਸੀਂ ਸਰ ਨਾਲ ਗੱਲ ਕਰ ਲਿਓ ਹਾਂਜੀ ਸਰ ਅਤੇ ਸਰ ਨੌਂ ਵਜੇ ਤੋਂ ਬਾਅਦ ਕਦੋਂ ਮਰਜੀ ਆ ਜਾਇਓ ਮਤਲਬ ਕਿ ਵੀ ਮੈਨੂੰ ਦੱਸ ਦਿਓ ਜੀ ਮੈਂ ਤੁਹਾਡਾ ਨੰਬਰ ਲਗਵਾ ਦਾਂਗੀ ਆਪਣਾ ਹਸਪਤਾਲ ਜੀ ਮਾਨਸਾ ਗਾ ਸਕੂਲ ਦੇ ਲਵੇ ਹੈ ਜੀ ਡੀ ਏ ਵੀ ਸਕੂਲ ਦੇ ਲਵੇ ਹਾਂਜੀ ਸਰ ਹਾਂਜੀ ਸਰ ਕੋਈ ਨਾ ਜੀ ਤੁਹਾਡਾ ਮੈਨੂੰ ਨਾਮ ਅਤੇ ਜੋ ਤੁਹਾਡਾ ਰਿਸ਼ਤੇਦਾਰ ਹੈ ਉਹ ਦੱਸ ਦਿਓ ਮੈਂ ਤੁਹਾਡੀ ਪਰਚੀ ਕੱਟ ਦਾਂਗੀ ਹਾਂਜੀ ਸਰ ਮੈਡੀਕਲ ਅੰਦਰ ਹੀ ਹੈ ਅਪੈਂਡਿਕਸ ਦੇ ਕਰਕੇ ਜੋ ਤੁਹਾਡਾ ਪੇਟ ਦਰਦ ਹੁੰਦਾ ਉਹ ਐਟਰਾਸਾਊਡ ਕਰਵਾਉਣ ਲਈ ਬਾਹਰ ਜਾਣਾ ਪਊ ਨਹੀਂ ਬਾਕੀ ਟੈਸਟ ਵੀ ਆਪਣੇ ਸਾਰੇ ਅੰਦਰ ਹੀ ਹੁੰਦੇ ਨੇ ਹਾਂਜੀ ਸਰ ਹਾਂਜੀ ਸਰ ਬਸ ਸਰ ਉਨ੍ਹਾਂ ਨੂੰ ਬੁਖ਼ਾਰ ਕਿਵੇਂ ਜਿਹੇ ਚੜ੍ਹਦਾ ਗਾ ਮਤਲਬ ਪਾਲਾ ਲੱਗ ਕੇ ਚੜ੍ਹਦਾ ਕੇ ਨੋਰਮਲ ਚੜ੍ਹਦਾ ਜੀ ਅੱਛਾ ਸਰ ਹਾਂਜੀ ਸਰ ਓਕੇ ਬਾਏ ਸਰ